ਮੇਰਾ ਛੋਟੀ ਹੁੰਦੀ ਤੋਂ ਬਹੁਤ ਹੀ ਜਿਆਦਾ ਮਤਲਬ ਸਪੇਸ ਨਾਲ ਰਿਲੇਟਡ ਮੂਵੀਜ ਦੇਖਣ ਦਾ ਬਹੁਤ ਹੀ ਜਿਆਦਾ ਇੰਟਰਸਟ ਸੀਗਾ ਠੀਕ ਹ ਜਿਵੇਂ ਆਪਾਂ ਨਿੱਕੇ ਹੁੰਦੇ ਤਾਰੇ ਵਗੈਰਾ ਦੇਖਦੇ ਸੀ ਚੰਦ ਵਗੈਰਾ ਦੇਖਦੇ ਸੀ ਸਪੇਸ ਵੱਲ ਵੇਖਦੇ ਰਹਿੰਦੇ ਸੀਗੇ ਵੀ ਸਪੇਸ ਕਿਹੋ ਜਿਹਾ ਹੁੰਦਾ ਹੈਗਾ ਉਹਦੇ ਨਾਲ ਹੀ ਰਿਲੇਟਡ ਇੱਕ ਛੋਟੇ ਹੁੰਦੇ ਆ ਇੱਕ ਫਿਲਮ ਆਈ ਸੀ ਜੀ ਦਾ ਨਾਮ ਸੀ ਕੋਈ ਮਿਲ ਜਾਏ ਮਿਲ ਜਾਏ ਮਿਲ ਗਿਆ ਜਾਦੂ ਵਾਲੀ ਸੀਗੀ ਮਤਲਬ ਵੀ ਉਹਦੇ ਵਿੱਚ ਉਹ ਜਿਹੜੀ ਫਿਲਮ ਸੀਗੀ ਉਹ ਕੀ ਆ ਰਿਤਿਕ ਰੋਸ਼ਨ ਦੀ ਸੀਗੀ ਉਹਦੇ ਵਿੱਚ ਕੀ ਕਹਾਣੀ ਦੱਸੀ ਗਈ ਸੀ ਵੀ ਜੋ ਰਿਤਿਕ ਰੋਸ਼ਨ ਦਾ ਫਾਦਰ ਹੁੰਦਾ ਹੈਗਾ ਉਹ ਕੀ ਹੈ ਇੱਕ ਸਾਇੰਟਿਸਟ ਹੁੰਦਾ ਹੈਗਾ ਐਂਡ ਜੋ ਰਿਤਿਕ ਰੋਸ਼ਨ ਹੁੰਦਾ ਉਹ ਥੋੜਾ ਵੀ ਜਿਵੇਂ ਆਪਾਂ ਕਹਿ ਸਕਦੇ ਆਂ ਦਿਮਾਗ ਤੋਂ ਅਪਸੈਟ ਹੁੰਦਾ ਹੈਗਾ ਠੀਕ ਹ ਉਹ ਮਤਲਬ ਆਪਦੇ ਪਾਪਾ ਦੀ ਜੋ ਵੀ ਉਹਨਾਂ ਨੇ ਸਾਇੰਟਿਫਿਕ ਤਰੀਕੇ ਦਾ ਨਾਲ ਇੱਕ ਬਲਾ ਬਣਾਈ ਸੀਗੀ ਠੀਕ ਹ ਐਂਡ ਉਹ ਕੀ ਆ ਉਹਨਾਂ ਦੇ ਨਾਲ ਕੀ ਆ ਵੀ ਮੀਨਸ ਆਪਾਂ ਪੰਜਾਬੀ ਚ ਕਹਿ ਸਕਦੇ ਹੋ ਵੀ ਭੰਗੇ ਵਗੈਰਾ ਲੈਂਦਾ ਰਹਿੰਦਾ ਸੀਗਾ ਉਹ ਨੇ ਥੋੜੇ ਜਿਵੇਂ ਮਸ਼ੀਨ ਦੇ ਵਿੱਚ ਕੀ ਹੈਗਾ ਉਹਨੇ ਕੁਝ ਕੁ ਜਿਆਦਾ ਹੀ ਬਟਨ ਜਿਵੇਂ ਦੱਬ ਦਿੱਤੇ ਸੀਗੇ ਤਾਂ ਉਹ ਕੰਟੈਕਟ ਹੋਇਆ ਉਹਦਾ ਉੱਥੇ ਏਲੀਅਨ ਦੇ ਨਾਲ ਸਪੇਸ ਦੇ ਵਿੱਚ ਠੀਕ ਹੈ ਤਾਂ ਉਹ ਜਿਹੜਾ ਏਲੀਅਨ ਸੀਗਾ ਉਹ ਧਰਤੀ ਤੇ ਆਇਆ ਠੀਕ ਹ ਫਿਰ ਉਹਦੇ ਧਰਤੀ ਤੇ ਆਇਆ ਉਹ ਕਰਸ਼ਨ ਦੇ ਨਾਲ ਉਹਦੇ ਨਾਲ ਗੂੜਾ ਪਿਆਰ ਮਤਲਬ ਉਹਦਾ ਬਣ ਗਿਆ ਠੀਕ ਹ ਤੇ ਉਨੇ ਵੀ ਮਤਲਬ ਉਹਨੂੰ ਰਿਤਿਕ ਰੌਸ਼ਨ ਨੂੰ ਕਿ ਉਹਨੇ ਜੋ ਜਾਦੂ ਸੀਗਾ ਵੀ ਮਤਲਬ ਰਿਤਿਕ ਰੋਸ਼ਨ ਨੇ ਉਹਦਾ ਨਾਮ ਜਾਦੂ ਰੱਖ ਦਿੱਤਾ ਸੀ ਵੀ ਉਹਨਾਂ ਕੋਈ ਵੀ ਜਿਵੇਂ ਪਾਸਕੇਟ ਬਾਲ ਵਗੈਰਾ ਖੇਡਦਾ ਸੀ ਕੋਈ ਵੀ ਕੰਮ ਕਰਦਾ ਸੀ ਤਾਂ ਉਹਨੂੰ ਕਿਹਾ ਪਾਵਰਸ ਮਿਲਦੀਆਂ ਹੁੰਦੀਆਂ ਸੀ ਉਸ ਸਾਧੂ ਦੇ ਕੋਲੋਂ ਠੀਕ ਹ ਐਂਡ ਅਖੀਰ ਦੇ ਵਿੱਚ ਕੀ ਹੈਗਾ ਜਦੋਂ ਉਹ ਵਾਪਸ ਜਾਣ ਲੱਗਿਆ ਤਾਂ ਰਿਤਿਕ ਰੌਸ਼ਨ ਬਹੁਤ ਹੀ ਜਿਆਦਾ ਇਮੋਸ਼ਨਲ ਹੋਇਆ ਸੋ ਇਹ ਜਿਹੜੀ ਫਿਲਮ ਸੀ ਇਸ ਫਿਲਮ ਨੇ ਕੀ ਹੈਗਾ ਬੀ ਬਹੁਤ ਹੀ ਬਹੁਤ ਹੀ ਜਿਆਦਾ ਮੈਨੂੰ ਸਪੇਸ ਨਾਲ ਰਿਲੇਟਡ ਬਹੁਤ ਹੀ ਵਧੀਆ ਇਹ ਮੇਰੀ ਫਿਲਮ ਲੱਗ ਗਈ ਤੇ ਮੈਂ ਇਹਨਾਂ ਨੂੰ ਵੇਖ ਕੇ ਬਹੁਤ ਹੀ ਜਿਆਦਾ ਵਧੀਆ ਵਧੀਆ ਫੀਲ ਕੀਤਾ ਸਪੇਸ ਵਾਲੀ ਪੇਸ ਵਾਲੇ ਵੀ ਆਪਾਂ ਨਿੱਕੇ ਹੁੰਦੇ ਸੀਗੇ ਜਾਦੂ ਵਾਲੇ ਕਈ ਚੀਜ਼ਾਂ ਵੀ ਆਉਣ ਲੱਗ ਪਏ ਸੀ ਪੈਕਟਸ ਵਗੈਰਾ ਵੀ ਆਉਣ ਲੱਗ ਪੈਂਦੇ ਸੀ ਸੋ ਇਹਦੇ ਨਾਲ ਕੀ ਹ ਇਹ ਜਿਹੜੀ ਫਿਲਮ ਸੀਗੀ ਬਹੁਤ ਹੀ ਜਿਆਦਾ ਫੇਵਰਟ ਬਣ ਗਈ ਸੀ ਨਿਕੇ ਹੁੰਦੇ